ਪੰਜਾਬ ਵਿੱਚ ਜਿਹੜੇ ਬਹੁਤ ਸਾਰੇ ਧਰਮ ਮੰਨੇ ਜਾਂਦੇ ਹੈਗੇ ਹੈ ਜਿੱਦਾਂ ਇੱਥੇ ਮਜੋਰਟੀ ਸਿੱਖ ਧਰਮ ਮਿਲਦਾ ਹੈਗਾ ਉਹ ਤੋਂ ਘੱਟ ਹਿੰਦੂ ਮੁਸਲਿਮ ਅਤੇ ਇਸਾਈ ਵੀ ਮਿਲਦੇ ਹੈਗੇ ਹੈ ਇਹ ਸਾਰੇ ਹੀ ਇੱਥੇ ਮਤਲਬ ਆਪਸ 'ਚ ਭਾਈਚਾਰੇ ਭਾਈਆਂ ਵਾਂਗੂੰ ਰਹਿੰਦੇ ਹੈਗੇ ਹੈ ਹਰ ਇੱਕ ਕੰਮ ਮੋਢੇ ਨਾਲ ਮੋਢਾ ਜੋੜ ਕੇ ਕਰਦੇ ਹੈਗੇ ਹੈ ਮਤਲਬ ਹਰ ਅਤੇ ਇੱਕ ਦੂਜੇ ਜਿਹੜੇ ਜਿਹੜੇ ਮਤਲਬ ਕੋਈ ਵੀ ਕੋਈ ਵੀ ਰਿਲੀਜ਼ਨ ਆ ਜਿਹੜਾ ਅਲੱਗ ਧਰਮ ਦਾ ਜਿਹੜਾ ਤਿਉਹਾਰ ਆਉਂਦਾ ਹੈਗਾ ਹੈ ਉਹਨੂੰ ਵੀ ਇਹ ਮਤਲਬ ਭਾਈਆਂ ਵਾਂਗੂੰ ਇਕੱਠੇ ਹੋ ਕੇ ਭਾਈਚਾਰੇ ਵਾਂਗੂੰ ਉਹਨਾਂ ਦੇ ਦੂਜੇ ਦੇ ਤਿਉਹਾਰ 'ਚ ਵੀ ਸ਼ਰੀਕ ਹੁੰਦੇ ਹੈਗੇ ਹੈ